ਮੇਰੀਆਂ ਮਨਪਸੰਦ ਦੀਆਂ ਮੱਛੀਆਂ ਦੇ ਵਿੱਚੋਂ ਦੋ ਤਿੰਨ ਤਰ੍ਹਾਂ ਦੀਆਂ ਖਾਸ ਨੇ ਜਿਵੇਂ ਸੋਲੀਮਨ ਤੁੰਨਾ ਸਾਲਡੀਨੈੱਸ ਆਦਿ ਅਤੇ ਇਹ ਮੱਛੀਆਂ ਸਾਡੇ ਇਲਾਕੇ ਦੇ ਵਿੱਚ ਜ਼ਿਆਦਾਤਰ ਪਾਈਆਂ ਜਾਂਦਿਆਂ ਨੇ ਅਤੇ ਅਕਸਰ ਹੀ ਮੈਂ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਫੰਕਸ਼ਨ ਦੇ ਉੱਤੇ ਜਦੋਂ ਜਾਂਦਾ ਤਾਂ ਇਹਨਾਂ ਤਿੰਨਾਂ ਦੇ ਵਿੱਚੋਂ ਕਿਸੇ ਤਰ੍ਹਾਂ ਦੀਆਂ ਮੱਛੀਆਂ ਜਿਹੜੀਆਂ ਉਹ ਖਾਣੀਆਂ ਪਸੰਦ ਕਰਦਾ ਹੁੰਦਾ ਵਾ ਅਤੇ ਇਹਦੇ ਵਿੱਚੋਂ ਆਮ ਤੌਰ 'ਤੇ ਜਿਹੜੇ ਲੋਕ ਹੋਰ ਤਰ੍ਹਾਂ ਦੀ ਮੱਛੀਆਂ ਖਾਂਦੇ ਨੇ ਉਹਨਾਂ ਵਿੱਚ ਟਰਾਊਟ ਤੂਨਾ ਮੈਕਰੀਅਲ ਕੋਪ ਸੀ ਓ ਪੀ ਜਾਂ ਤੇਲਾਪੀਆ ਜਾਂ ਪੁਲੋਕ ਇੱਦਾਂ ਦੀਆਂ ਜਿਹੜੀਆਂ ਟਾਇਪਸ ਦੀਆਂ ਮੱਛੀਆਂ ਨੇ ਜ਼ਿਆਦਾਤਰ ਲੋਕ ਉਹ ਖਾਣੀਆਂ ਪਸੰਦ ਕਰਦੇ ਨੇ ਅਤੇ ਆਪਣੇ ਆਪਣੇ ਵੱਖਰੇ ਵੱਖਰੇ ਜੋ ਖੇਤਰ ਨੇ ਉਹਨਾਂ ਦੇ ਖੇਤਰਾਂ ਵਿੱਚ ਵੱਖਰੇ ਵੱਖਰੇ ਤਰ੍ਹਾਂ ਦੀਆਂ ਮੱਛੀਆਂ ਮਿਲਦੀਆਂ ਨੇ ਅਤੇ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਇਸ ਤਰ੍ਹਾਂ ਦੀਆਂ ਮੱਛੀਆਂ ਖਾਣੀਆਂ ਹੀ ਪਸੰਦ ਕਰਦੇ ਨੇ